ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਬੋਲੋ ਮੁਕਤਸਰ ਵਿਚ ਸਭ ਤੋਂ ਪ੍ਰਸਿੱਧ ਮੇਲਾ ਮਾਘੀ ਦਾ ਮੇਲਾ ਮਨਾਇਆ ਤੇ ਮਾਘੀ ਦੇ ਮੇਲੇ ਵਿੱਚ ਪੰਜਾਬੀ ਇਤਿਹਾਸਕਾਰ ਅਤੇ ਧਾਰਮਿਕ ਮਹੱਤਤਾ ਰੱਖਦਾ ਹੈ ਲੇਕਿਨ ਪੰਜਾਬੀ ਵਿੱਚ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜੀ ਤੇ ਇਹ ਮੇਲਾ ਮੁਕਤਸਰ ਵਿੱਚ ਮਾਘ ਦੇ ਮਹੀਨੇ ਪਹਿਲੀ ਤਾਰੀਖ ਨੂੰ ਮਾਘ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ ਇਸ ਮੇਲੇ ਨੂੰ ਚਾਲੀ ਮੁਕਤਿਆਂ ਦੀ ਸ਼ਹੀਦੀ ਯਾਦ ਕਰਨ ਦੇ ਪ੍ਰਯੋਜਨ ਵਜੋਂ ਵੀ ਮਨਾਇਆ ਜਾਂਦਾ ਹੈ ਹਾਂਜੀ ਤੇ ਮੇਲੇ ਬਹੁਤ ਲੋਕ ਬਹੁਤ ਵੱਡਾ ਮੇਲਾ ਹੁੰਦਾ ਮਤਲਬ ਬਹੁਤ ਸਾਰੇ ਲੋਕ ਹੁੰਦੇ ਆ ਹੀ ਮੇਲਾ ਦੇਖਣ ਲਈ ਬਹੁਤ ਸਾਰੇ ਕੰਟੀਨਾਂ ਲੱਗੀਆਂ ਹੁੰਦੀਆਂ ਨੇ ਮਤਲਬ ਬਹੁਤ ਸਾਰੇ ਲੋਕ ਵਧੀਆ ਬਣ ਥਾਂਣ ਕੇ ਆਉਂਦੇ ਨੇ ਮੇਲਾ ਦੇਖਣ ਲਈ ਵਧੀਆ ਹਾਂਜੀ ਇਹ ਮੇਲਾ ਦੱਸ ਦਿਨ ਪਹਿਲਾਂ ਤੇ ਮਕਤਸਰ ਇਹ ਮੇਲਾ ਪੰਜਾਬੀਆਂ ਲਈ ਇਤਿਹਾਸਕਾਰ ਅਤੇ ਧਾਰਮਿਕ ਮਹੱਤਤਾ ਲੱਗਦਾ ਇਸ ਲਈ ਹੋਰ ਸ਼ਰਧਾ ਤੇ ਭਾਵਨਾ ਨਾਲ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਹਾਂਜੀ ਇਹ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਯਾਦ ਕਰਕੇ ਪਰਜੋਈਨ ਵਜੋਂ ਮਨਾਇਆ ਜਾਂਦਾ ਹਾਂਜੀ ਹਾਂਜੀ ਪਹਿਲੀ ਤਰੀਕ ਸੰਗਰਾਂਦ ਦੀ ਮਨਾਇਆ ਜਾਂਦਾ ਹਾਂਜੀ ਲੋਕ ਵਨੂ ਸੋਨੀ ਸੁੰਦਰ ਦੇਸ਼ ਭੂਸ਼ਾ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੁੱਖ ਮਕਸਦ ਦੇ ਮੇਲੇ ਵਿੱਚ ਪਹੁੰਚਦੇ ਹਨ ਤੇ ਮੁਕਤਸਰ ਦੀ ਮਾਘੀ ਦਾ ਮੇਲਾ ਪੁਰਾਤਨ ਸਮੇਂ ਤੋਂ ਹੀ ਖਿੱਚਦਾ ਕੇਂਦਰ ਰਿਹਾ ਹਾਂਜੀ ਕਿਲੇ ਚ ਬਹੁਤ ਸਾਰੇ ਝੂਲੇ ਲੱਗੇ ਹੁੰਦੇ ਹਨ ਤੇ ਬਹੁਤ ਸਾਰੇ ਲੋਕ ਬਹੁਤ ਭੀੜ ਹੁੰਦੀ ਦੇ ਵਿੱਚ ਬਹੁਤ ਸਾਰੇ ਲੋਕ ਇਹ ਮੇਲਾ ਦੇਖਣ ਆਉਂਦੇ ਹਨ ਓਕੇ ਜੀ ਥੈਂਕ ਯੂ